ਸਾਡੇ ਪਿੰਡ ਵਿੱਚ ਹਸਪਤਾਲ ਦੇ ਕਈ ਕਾਰਨ ਹਨ ਸਾਨੂੰ ਇੱਥੇ ਕਈ ਵਾਰ ਜਦੋਂ ਅਸੀਂ ਹਸਪਤਾਲ ਵਿੱਚ ਜਾਂਦੇ ਹਾਂ ਤਾਂ ਸਾਨੂੰ ਕੋਈ ਡਾਕਟਰ ਨਹੀਂ ਮਿਲਦਾ ਜਾਂ ਕੋਈ ਮਸ਼ੀਨਾਂ ਨਹੀਂ ਮਿਲਦੀਆਂ ਜਾਂ ਕੋਈ ਐਕਸਰਾ ਐਕਸਰਾ ਕਰਾਉਣ ਜਾਂਦੇ ਹਾਂ ਤਾਂ ਉਹਨਾਂ ਦੀਆਂ ਮਸ਼ੀਨਾਂ ਨਹੀਂ ਮਿਲਦੀਆਂ ਇਸ ਕਰਕੇ ਇਸ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ ਹੈ ਨਾ ਅਤੇ ਫਿਰ ਅਸੀਂ ਇਸ ਕਰਕੇ ਅਸੀਂ ਪਿੰਡਾਂ ਦੇ ਵਿੱਚੋਂ ਜਾ ਕੇ ਸ਼ਹਿਰ ਵਿੱਚ ਰਹਿਣਾ ਪਸੰਦ ਕਰਦੇ ਹਾਂ ਕਿਉਂਕਿ ਕਿ ਸ਼ਹਿਰ ਵਿੱਚ ਜਦੋਂ ਸ਼ਹਿਰਾਂ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਸ਼ਹਿਰ ਵਿੱਚ ਜਾ ਕੇ ਦਵਾਈ ਵੀ ਲੈ ਸਕਦੇ ਹਾਂ ਤਾਂ ਸਾਡੇ ਬੱਚਿਆਂ ਨੂੰ ਕੋਈ ਦਿੱਕਤ ਆਉਂਦੀ ਤਾਂ ਅਸੀਂ ਉੱਥੇ ਲੈ ਜਾ ਲਿਜਾ ਸਕਦੇ ਹਾਂ ਬੱਚਿਆਂ ਨੂੰ ਦਵਾਈ ਦਵਾ ਸਕਦੇ ਹਾਂ ਅਤੇ ਅਸੀਂ ਜੇ ਵੀ ਕੋਈ ਵੀ ਸਾਨੂੰ ਹੋਣ ਦਾ ਤਾਂ ਸ ਹਸਪਤਾਲ ਵਿੱਚ ਜਾ ਕੇ ਸ਼ਹਿਰ ਵਿੱਚ ਸਾਨੂੰ ਹਰ ਇੱਕ ਚੀਜ਼ ਦਾ ਹੱਲ ਨਿਕਲ ਜਾਂਦਾ ਹੈ ਅਤੇ ਇਸ ਲਈ ਇਸ ਕਰਕੇ ਅਸੀਂ ਸ਼ਹਿਰ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਾਂ